ਵੱਖ ਵੱਖ ਮੌਸਮੀ ਸਥਿਤੀਆਂ ਦੇ ਵਿੱਚ ਜਿਵੇਂ ਕਿ ਗਰਮ ਠੰਢ ਬਰਸਾਤ ਇਹਨਾਂ ਦੇ ਵਿੱਚ ਦੌੜਨ ਲਈ ਸਾਨੂੰ ਆਪਣੀ ਸਿਹਤ ਦਾ ਸਭ ਤੋਂ ਪਹਿਲਾਂ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਭੱਜਣ ਦੇ ਨਾਲ ਜਿਹੜੀ ਸਰੀਰ ਦੀ ਗਰਮੀ ਹੈ ਵੱਧ ਜਾਂਦੀ ਹੈ ਤਾਂ ਇਸ ਕਾਰਨ ਸਾਨੂੰ ਗਰਮੀ ਦੇ ਵਿੱਚ ਸਾਨੂੰ ਛੋਟੇ ਕੱਪੜੇ ਜਾਂ ਫਿਰ ਹਲਕੇ ਜਿਨ੍ਹਾਂ ਦੇ ਵਿੱਚ ਹਵਾਦਾਰ ਕੱਪੜੇ ਹੋਣ ਉਹ ਪਾ ਕੇ ਦੌੜਨਾ ਚਾਹੀਦਾ ਹੈ ਹੋ ਸਕੇ ਤਾਂ ਸਾਨੂੰ ਜਿਹੜਾ ਸਾਡਾ ਸਰੀਰ ਉੱਪਰਲਾ ਸਰੀਰ ਹੈ ਉਹਨੂੰ ਨਗਨ ਹੀ ਅਸੀਂ ਜੇ ਕਰੀਏ ਤਾਂ ਉਹਦੇ ਨਾਲ ਅਸੀਂ ਦੌੜ ਸਕਦੇ ਹਾਂ ਠੰਡ ਦੇ ਵਿੱਚ ਸਾਨੂੰ ਆਪਣੇ ਕੱਪੜੇ ਪੂਰੇ ਪਾਉਣੇ ਚਾਹੀਦੇ ਹੈ ਤਾਂ ਕਿ ਸਾਨੂੰ ਸਾਡੇ ਸਰੀਰ ਨੂੰ ਠੰਡ ਨਾ ਲੱਗ ਜਾਵੇ ਜਿਵੇਂ ਕਿ ਟਰੇਂਕ ਸੂਟ ਹੋ ਗਿਆ ਇਹਨਾਂ ਦੇ ਵਿੱਚ ਅਸੀਂ ਭੱਜ ਸਕਦੇ ਹਾਂ ਬਰਸਾਤ ਦੇ ਵਿੱਚ ਮੇਰੀ ਰਾਏ ਇਹ ਹੈ ਕਿ ਸਾਨੂੰ ਨਹੀਂ ਭੱਜਣਾ ਚਾਹੀਦਾ ਸਰੀਰ ਗਰਮ ਹੋ ਜਾਂਦਾ ਹੈ ਅਤੇ ਪਾਣੀ ਠੰਡਾ ਜਿਸ ਕਾਰਨ ਗਰਮ ਸਰਦ ਵੀ ਹੋ ਜਾਂਦਾ ਹੈ ਅਤੇ ਸਿਹਤ ਵਿਗੜ ਜਾਂਦੀ ਹੈ